ਪੁਰਾਣੇ ਸਮੇਂ ਦੇ ਗੀਤਾਂ ਵਿੱਚ ਅਤੇ ਨਵੇਂ ਸਮੇਂ ਦੇ ਗੀਤਾਂ ਵਿੱਚ ਬਹੁਤ ਜ਼ਿਆਦਾ ਫਰਕ ਹੈ ਪੁਰਾਣੇ ਸਮੇਂ ਦੇ ਗੀਤਾਂ ਵਿੱਚ ਸ਼ਰਮ ਹਿਆ ਦਾ ਪੂਰਾ ਪੂਰਾ ਧਿਆਨ ਰੱਖਿਆ ਜਾਂਦਾ ਸੀਗਾ ਸਾਰੇ ਗੀਤ ਹੁੰਦੇ ਸੀਗੇ ਜਿਹੜੇ ਕਿ ਟੱਬਰ ਵਿੱਚ ਬੈਠ ਕੇ ਸੁਣਨ ਵਾਲੇ ਹੁੰਦੇ ਸੀਗੇ ਬਟ ਜੇ ਅਸੀਂ ਅੱਜ ਕੱਲ੍ਹ ਦੇ ਗੀਤਾਂ ਦੀ ਗੱਲ ਕਰੀਏ ਤਾਂ ਇਹੋ ਜਿਹਾ ਕੋਈ ਗੀਤ ਨਹੀਂ ਹੈਗਾ ਜਿਹੜਾ ਕਿ ਟੱਬਰ 'ਚ ਬੈਠ ਕੇ ਸੁਣਨ ਵਾਲਾ ਹੋਵੇ ਅੱਜ ਪੁਰਾਣੇ ਸਮੇਂ ਦੇ ਗੀਤਾਂ ਵਿੱਚ ਮਾਂ ਦੀ ਪਿਓ ਦੀ ਦਾਦੀਆਂ ਦੀ ਨਾਨੀਆਂ ਦੀ ਗੱਲ ਕੀਤੀ ਹੁੰਦੀ ਸੀਗੀ ਬਟ ਅੱਜ ਕੱਲ੍ਹ ਦੇ ਸਮਿਆਂ ਦੇ ਵਿੱਚ ਬੋਏਫਰੈਂਡ ਅਤੇ ਗਰਲਫਰੈਂਡ ਦੇ ਬਾਰੇ ਗੱਲ ਕੀਤੀ ਹੁੰਦੀ ਆ ਜੋ ਕਿ ਅੱਜ ਆਉਣ ਵਾਲੀ ਪੀੜ੍ਹੀ ਦੇ ਲਈ ਅਤੇ ਅੱਜ ਕੱਲ੍ਹ ਦੀ ਪੀੜੀ ਦੇ ਲਈ ਇੱਕ ਚੰਗਾ ਸੰਦੇਸ਼ ਨਹੀਂ ਹੈ ਪਿਛਲੀ ਵਾਰੀ ਜਿੱਦਾਂ ਕਿ ਹੁਣ ਮੇਰਾ ਸਭ ਤੋਂ ਮਨ ਪਸੰਦ ਅ ਗਾਣਾ ਹੈਗਾ ਆ ਜੋ ਕਿ ਕੁਲਦੀਪ ਮਾਣਕ ਜੀ ਦਾ ਹੈ ਪੇਕੇ ਹੁੰਦੇ ਮਾਵਾਂ ਨਾਲ ਉਹਦੇ ਵਿੱਚ ਇੱਕ ਮਾਂ ਦੀ ਰਿਐਲਿਟੀ ਜੋ ਹੈ ਮਾਂ ਦਾ ਕੀ ਰੁਤਬਾ ਏ ਕਿ ਜਿਹੜਾ ਸਾਡਾ ਕੁੜੀਆਂ ਦਾ ਪੇਕੇ ਘਰ ਆ ਉਹ ਮਾਵਾਂ ਦੇ ਨਾਲ਼ ਹੀ ਜਦੋਂ ਤੱਕ ਮਾਵਾਂ ਜਿਉਂਦੀਆਂ ਏ ਆ ਉਦੋਂ ਤੱਕ ਹੀ ਪੇਕਾ ਘਰ ਏ ਉਸ ਜਦੋਂ ਤੱਕ ਮਾਵਾਂ ਨਹੀਂ ਤਾਂ ਉਹਨਾਂ ਦਾ ਕੋਈ ਪੇਕੇ ਘਰ ਨਹੀਂ ਹੁੰਦਾ ਜੋ ਕਿ ਇੱਕ ਆਪਣੇ ਆਪ ਦੇ ਵਿੱਚ ਇੱਕ ਅਸਲੀਅਤ ਵੀ ਹੈ ਪੁਰਾਣੇ ਸਮੇਂ ਦੇ ਗੀਤ ਇੱਕ ਜੋ ਅਸਲੀਅਤ ਹੁੰਦੀ ਸੀਗੀ ਉਹਨਾਂ ਨੂੰ ਪੇਸ਼ ਕਰਦੇ ਸੀਗੇ ਪਰ ਅੱਜ ਕੱਲ੍ਹ ਦੇ ਗੀਤਾਂ ਦੇ ਵਿੱਚ ਇਹੋ ਜਿਹੀ ਕੁਝ ਵੀ ਪੇਸ਼ਕਸ਼ ਨਹੀਂ ਰਹੀ ਹੈਗੀ ਅੱਜ ਕੱਲ੍ਹ ਦੇ ਜੋ ਵੀ ਲੱਚਰ ਢੰਗ ਏ ਆ ਜੋ ਵੀ ਆ ਉਹ ਬਸ ਪੇਸ਼ ਕਰਦੇ ਰਹਿੰਦੇ ਹਨ ਜੋ ਉਨਾਂ ਦੇ ਆਉਂਦਾ ਏ ਆ ਦਿਲ ਦੇ ਵਿੱਚ ਪਰ ਜੇਕਰ ਆਪਾਂ ਪੁਰਾਣੇ ਗੀਤਾਂ ਦੀ ਗੱਲ ਕਰੀਏ ਉਹ ਇੱਕ ਸੱਭਿਅਤਾ ਨਾਲ ਭਰੇ ਹੁੰਦੇ ਸੀਗੇ ਸੱਭਿਅਤਾ ਨਾਲ ਸਮਾਜਿਕ ਹੁੰਦੇ ਸੀਗੇ ਠੀਕ ਹੈ ਅੱਜ ਕੱਲ੍ਹ ਦੇ ਜੇ ਅਸੀਂ ਗੀਤ ਦੇਖੀਏ ਅੱਜ ਕੱਲ੍ਹ ਦੇ ਗੀਤ ਦੇ ਵਿੱਚ ਪਹਿਲੇ ਬੇਸ਼ੱਕ ਕੁੜੀਆਂ ਵੀ ਆਉਂਦੀਆਂ ਸੀਗੀਆਂ ਪਰ ਉਹ ਚੰਗੇ ਲੀੜੇ ਪਾਉਂਦੀਆਂ ਸੀ ਅੱਜ ਕੱਲ੍ਹ ਦੇ ਚੰਗੇ ਲੀੜੇ ਨਹੀਂ ਪਾਉਂਦੀਆਂ ਹਨ